ਗਾਂਧੀ ਜੀ ਦੁਆਰਾ ਅੰਗਰੇਜ਼ਾਂ ਵਿਰੁੱਧ ਲੜਾਈ ਵਿੱਚ ਕਈ ਅੰਦੋਲਨ ਕੀਤੇ ਗਏ ਜਿਸ ਵਿੱਚ ਲੂਣ ਅੰਦੋਲਨ ਜੋ ਕਿ ਲੂਣ ਸੱਤਿਆਗ੍ਰਹਿ ਨਾਮ ਵਜੋਂ ਜਾਣਿਆ ਜਾਂਦਾ ਹੈ ਜਿਸ ਨੂੰ ਕਿ ਗਾਂਧੀ ਜੀ ਦੁਆਰਾ ਬਾਰ੍ਹਾਂ ਮਾਰਚ ਉੱਨੀ ਸੌ ਤੀਹ ਵਿੱਚ ਸਟਾਰਟ ਕੀਤਾ ਗਿਆ ਜੋ ਕਿ ਇੱਕ ਚੌਵੀ ਦਿਨਾਂ ਦਾ ਮਾਰਚ ਸੀ ਅਤੇ ਉਹ ਛੇ ਅਪ੍ਰੈਲ ਉੱਨੀ ਸੌ ਤੀਹ ਨੂੰ ਖਤਮ ਕੀਤਾ ਗਿਆ ਇਹ ਇੱਕ ਬਹੁਤ ਹੀ ਅਹਿਮ ਸੱਤਿਆਗ੍ਰਹਿ ਸੀ ਜਿਸ ਨਾਲ ਕਿ ਲੋਕਾਂ ਵਿੱਚ ਬ੍ਰਿਟਿਸ਼ ਵਿਰੁੱਧ ਇਕ ਜੰਗ ਹੀ ਛਿੜ ਗਈ ਇਸ ਤੋਂ ਇਲਾਵਾ ਗਾਂਧੀ ਜੀ ਦੁਆਰਾ ਕਈ ਅੰਦੋਲਨ ਕੀਤੇ ਗਏ ਜਿਹਨਾਂ ਵਿੱਚੋਂ ਇੱਕ ਅਸਹਿਯੋਗ ਅੰਦੋਲਨ ਵੀ ਹੈ ਜਿਸ ਨੂੰ ਕਿ ਗਾਂਧੀ ਜੀ ਦੁਆਰਾ ਚਲਾਇਆ ਗਿਆ ਗਾਂਧੀ ਜੀ ਦੁਆਰਾ ਤੇਰ੍ਹਾਂ ਅਪ੍ਰੈਲ ਉੱਨੀ ਸੌ ਉੱਨੀ ਵਿੱਚ ਜਲਿਆਂਵਾਲਾ ਬਾਗ ਵਿੱਚ ਜਦੋਂ ਕਿ ਜਰਨਲ ਡਾਇਰ ਦੁਆਰਾ ਲੋਕਾਂ 'ਤੇ ਗੋਲੀ ਚਲਾਈ ਗਈ ਇਸ ਤੋਂ ਬਾਅਦ ਅਸਹਿਯੋਗ ਅੰਦੋਲਨ ਚਲਾਇਆ ਗਿਆ ਇਹ ਵੀ ਇੱਕ ਬਹੁਤ ਵੱਡਾ ਅੰਦੋਲਨ ਸੀ ਇਸ ਤੋਂ ਇਲਾਵਾ ਸਵਦੇਸੀ ਅੰਦੋਲਨ ਵੀ ਚਲਾਇਆ ਗਿਆ ਜੋ ਕਿ ਗਾਂਧੀ ਜੀ ਦੁਆਰਾ ਸੱਤ ਅਗਸਤ ਉੱਨੀ ਸੌ ਪੰਜਾਹ ਨੂੰ ਚਲਾਇਆ ਗਿਆ ਇਹ ਸਭ ਅੰਦੋਲਨ ਦਾ ਇੱਕੋ ਇੱਕ ਮਕਸਦ ਸੀ ਕਿ ਦੇਸ਼ ਨੂੰ ਆਜ਼ਾਦ ਕਰਵਾਉਣਾ ਅਤੇ ਅੰਗਰੇਜ਼ਾਂ ਵਿਰੁੱਧ ਲੜਾਈ ਵਿੱਚ ਅਹਿਮ ਯੋਗਦਾਨ ਪਾਉਣਾ ਹੋਰ ਵੀ ਹੋਰ ਵੀ ਕਈ ਨੇਤਾਵਾਂ ਵਜੋਂ ਬੜੇ ਅੰਦੋਲਨ ਚਲਾਏ ਗਏ ਜਿਵੇਂ ਕਿ ਲਾਲਾ ਲਾਜਪਤ ਰਾਏ ਵੱਲੋਂ ਹੋਮ ਰੂ ਇੰਡੀਅਨ ਹੋਮ ਰੂਲ ਲੀਗ ਦੀ ਸਥਾਪਨਾ ਕੀਤੀ ਗਈ ਅਤੇ ਬਹੁਤ ਸਾਰੇ ਅੰਦੋਲਨ ਚਲਾਏ ਗਏ